ਮੇਰਾ ਨਾਮ ਜਸਪ੍ਰੀਤ ਹੈ ਮੈਂ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਦੀ ਵਸਨੀਕ ਹਾਂ ਮੈਂ ਆਪਣੇ ਡੇਲੀ ਦੇ ਰੂਟੀਨ ਵਿੱਚ ਸਭ ਤੋਂ ਪਹਿਲਾਂ ਸੁਬਹਾ ਉੱਠ ਕੇ ਰਨਿੰਗ ਕਰਦੀ ਹਾਂ ਰਨਿੰਗ ਕਰਨ ਅਤੇ ਅਸੀਂ ਸਾਡੇ ਪਿੰਡ ਤੋਂ ਅੱਧਾ ਕਿਲੋਮੀਟਰ ਦੂ ਦੂਰ ਮੰਡੀ ਹੈ ਉੱਥੇ ਅਸੀਂ ਰਨਿੰਗ ਕਰਦੇ ਹਾਂ ਵਧੀਆ ਭੱਜ ਦੌੜ ਕਰਦੇ ਹਾਂ ਅਤੇ ਅਸੀਂ ਉੱਥੇ ਵੀ ਕਈ ਤਰ੍ਹਾਂ ਦੀਆਂ ਕਸਰਤਾਂ ਵੀ ਕਰਦੇ ਹਾਂ ਇਸ ਤੋਂ ਬਾਅਦ ਅਸੀਂ ਸਕੂਲ ਜਾਂਦੇ ਹਾਂ ਉੱਥੇ ਵੀ ਸਾਨੂੰ ਇਸ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਵੀ ਕਸਰਤ ਕਰਨ ਲਈ ਰੂਟੀਨ ਵਿੱਚ ਵੀ ਕਸ ਕਸਰਤ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਇਸ ਨਾਲ ਸਾਡੇ ਸਰੀਰ 'ਚ ਲਚਕਤਾ ਪੈਦਾ ਹੁੰਦੀ ਏ ਅਤੇ ਸਰੀਰ ਦੀ ਬਣਾਵਟ ਵੀ ਬਣੀ ਰਹਿੰਦੀ ਹੈ ਲਚਕਤਾ ਦਾ ਹੋਣਾ ਵੀ ਸਾਡੇ ਸਰੀਰ ਵਿੱਚ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ ਲਚਕਤਾ ਪੈਦਾ ਹੋਣ ਕਰਕੇ ਅਸੀਂ ਕੋਈ ਵੀ ਕਸਰਤ ਕਰ ਸਕਦੇ ਹਾਂ ਅਸੀਂ ਆਪਦੇ ਅੰਗਾਂ ਨੂੰ ਕਿੱਦਾਂ ਵੀ ਮੋੜ ਸਕਦੇ ਹਾਂ ਕਿੱਦਾਂ ਵੀ ਕੋਈ ਵੀ ਕਸਰਤ ਕਰ ਸਕਦੇ ਹਾਂ ਇਸ ਲਈ ਲਚਕਤਾ ਦਾ ਹੋਣਾ ਸਾਡੇ ਸਰੀਰ ਵਿੱਚ ਬਹੁਤ ਹੀ ਜ਼ਰੂਰੀ ਹੈ ਖਿੱਚਣ ਅਸੀਂ ਕਿਸੇ ਚੀਜ਼ ਨੂੰ ਕਿੱਦਾਂ ਖਿੱਚ ਸਕਦੇ ਹਾਂ ਕਿੱਦਾਂ ਕੋਈ ਚੀਜ਼ ਅਤੇ ਕਿੱਦਾਂ ਜ਼ੋਰ ਪਾ ਸਕਦੇ ਹਾਂ ਇਸ ਚੀਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਤਾਂ ਹੀ ਆਉਣਗੀਆਂ ਜੇ ਅਸੀਂ ਡੇਲੀ ਰੂਟੀਨ 'ਚ ਆਪਣੀ ਕਸਰਤ ਕਰਾਂਗੇ ਅਤੇ ਰਨਿੰਗ ਕਰਾਂਗੇ ਸਾਨੂੰ ਆਪਣਾ ਰੂਟੀਨ ਬਣਾਉਣਾ ਚਾਹੀਦਾ ਸੁਬਹਾ ਉੱਠ ਕੇ ਸਾਨੂੰ ਪਹਿਲਾਂ ਰਨਿੰਗ ਕਰਨੀ ਚਾਹੀਦੀ ਹੈ ਫਿਰ ਸਾਨੂੰ ਕੋਈ ਇੱਦਾਂ ਦੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਲੰਬੇ ਸਾਹ ਲੈਣਾ ਆਪਣੇ ਹੱਥਾਂ ਨੂੰ ਅੰਗੂਠਿਆਂ ਤੱਕ ਲੈ ਕੇ ਜਾਣਾ ਆਪਣੀ ਗਰਦਨ ਨੂੰ ਪਿੱਛੇ ਮੋੜਨਾ ਇੱਦਾਂ ਦੀਆਂ ਸਾਨੂੰ ਕਸਰਤਾਂ ਕਰਨੀਆਂ ਚਾਹੀਦੀਆਂ ਹਨ ਸਾਨੂੰ ਸੂਬਹਾ ਖਾਲੀ ਪੇਟ ਇਹ ਸਾਰੀਆਂ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਥਾ ਸਾਡੇ ਸਰੀਰ ਨੂੰ ਵਧੀਆ ਤੰਦਰੁਸਤੀ ਮਿਲ ਸਕੇ ਅਸੀਂ ਵਧੀਆ ਸਾਡਾ ਖਾਣਾ ਪੀਣਾ ਪਾਚਨ ਤੰਤਰ ਬਿਲਕੁਲ ਸਹੀ ਹੋ ਅਤੇ ਸਰੀਰ ਨੂੰ ਤੰਦਰੁਸਤ ਬਣਿਆ ਰਹੇ ਇਸ ਤਰ੍ਹਾਂ ਤੁਸੀਂ ਆਪਣੀ ਚੱਲ ਰਹੀ ਰੂਟੀਨ ਵਿੱਚ ਤਾਕਤ ਅਤੇ ਲਚਕਨਾ ਸਿਲਾ ਸਿਖਲਾਈ ਨੂੰ ਵੀ ਸ਼ਾਮਿਲ ਕਰ ਸਕਦੇ ਹੋ ਲਚਕਦਾ ਹੋਣਾ ਲਚਕਤਾ ਦਾ ਹੋਣਾ ਵੀ ਸਾਡੇ ਸਰੀਰ ਵਿੱਚ ਬਹੁਤ ਜ਼ਰੂਰੀ ਹੈ